ਵਾਤਾਵਰਨ ਨੂੰ ਅਸੀਂ ਸਾਫ ਇਸ ਤਰ੍ਹਾਂ ਰੱਖ ਸਕਦੇ ਹਾਂ ਕਿ ਅਸੀਂ ਜਦੋਂ ਵੀ ਕਦੇ ਵੀ ਬਾਹਰ ਜਾਈਏ ਤਾਂ ਕੋਈ ਵੀ ਕੂੜਾ ਕਰਕਟ ਅਸੀਂ ਸੜਕਾਂ ਦੇ ਉੱਤੇ ਐਵੇਂ ਨਾ ਸੁੱਟੀਏ ਜਿਸ ਕਰਕੇ ਆਪਣਾ ਵਾਤਾਵਰਨ ਕੀ ਹੈ ਪ੍ਰਦੂਸ਼ਿਤ ਹੋ ਰਿਹਾ ਹੈ ਅਸੀਂ ਜ਼ਿਆਦਾਤਰ ਵਹੀਕਲਸ ਚਲਾਉਣੇ ਹੈਗੇ ਹਾਂ ਅੱਜ ਕੱਲ੍ਹ ਉਹਦੇ ਵਿੱਚ ਵੀ ਉਹਦੇ ਕਰਕੇ ਵੀ ਆਪਣਾ ਵਾਤਾਵਰਨ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਜਿਹਦੇ ਕਰਕੇ ਆਪਣਾ ਮੌਸਮ ਹੈ ਜੋ ਉਹ ਜਲਦੀ ਨਾਲ ਬਦਲਾਵ ਉਹਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਵਾਤਾਵਰਨ ਨੂੰ ਸਾਫ ਰੱਖਣ ਦੇ ਕੁਛ ਤਰੀਕੇ ਹੁੰਦੇ ਹਨ ਜਿਵੇਂ ਕਿ ਆਪਾਂ ਉਹਦੇ ਵਿੱਚ ਕੁਛ ਵੀ ਗਲਤ ਨਾ ਕਰੀਏ ਕੁਛ ਅ ਕੋਈ ਵੀ ਕੂੜਾ ਕਰਕਟ ਇੱਧਰ ਉੱਧਰ ਨਾ ਸੁੱਟੀਏ ਐਸ ਇਹਦੇ ਨਾਲ ਅਸੀਂ ਇੱਕ ਦੂਜੇ ਦੇ ਨਾ ਨੂੰ ਵੀ ਸਹੀ ਜੀਵਨ ਦੇ ਸਕਦੇ ਹਾਂ ਅਤੇ ਵਾਤਾਵਰਨ ਨੂੰ ਵੀ ਸਾਫ ਰੱਖ ਸਕਦੇ ਹਾਂ ਵਾਤਾਵਰਨ ਨੂੰ ਸਾਫ ਰੱਖਣ ਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਜਿਵੇਂ ਕਿ ਇ ਅਸੀਂ ਜਿੱਥੇ ਵੀ ਜਾਂਦੇ ਹਾਂ ਤਾਂ ਅਸੀਂ ਕੁਛ ਵੀ ਕੂੜਾ ਕਰਕਟ ਹੈ ਜੋ ਉਹ ਬਾਹਰ ਹੀ ਨਾ ਸੁੱਟੀਏ ਉਹਦੀ ਬਜਾਏ ਅਸੀਂ ਉਹਨੂੰ ਇੱਕ ਡਸਟਬੀਨ ਦੇ ਵਿੱਚ ਸੁੱਟੀਏ ਤਾਂ ਕਿ ਜੋ ਆਪਣਾ ਵਾਤਾਵਰਨ ਹੈ ਉਹ ਪ੍ਰਦੂਸ਼ਿਤ ਨਾ ਹੋ ਸਕੇ ਅਤੇ ਅਸੀਂ ਜੋ ਵੀ ਕੂੜਾ ਕਰਕਟ ਹੈ ਉਹਨੂੰ ਰੀਸਾਈਕਲ ਕਰੀਏ ਪਲਾਸਟਿਕ ਦੀਆਂ ਚੀਜ਼ਾਂ ਨੂੰ ਵੀ ਰੀਸਾਈਕਲ ਕਰੀਏ ਜਿਹਦੇ ਕਰਕੇ ਸਾਡਾ ਜੋ ਇਨਵਾਇਰਮੈਂਟ ਵਾਤਾਵਰਨ ਹੈ ਉਹ ਕੀ ਬਣੇ ਇਹ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ ਇਸ ਨਾਲ ਹੀ ਅਸੀਂ ਉਹਨੂੰ ਵਾਤਾਵਰਨ ਨੂੰ ਸਾਫ ਰੱਖ ਸਕਦੇ ਹਾਂ ਪਲਾਸਟਿਕ ਦੀਆਂ ਚੀਜ਼ਾਂ ਨੂੰ ਰੀਸਾਈਕਲ ਕਰਕੇ ਜੋ ਵੀ ਸਮਾਨ ਹੈ ਉਹਨੂੰ ਖਾਦ ਦੀ ਤਰ੍ਹਾਂ ਯੂਜ ਕਰਕੇ ਅਸੀਂ ਕੋਈ ਵੀ ਵਾਤਾਵਰਨ ਨੂੰ ਸਾਫ ਰੱਖ ਸਕਦੇ ਹਾਂ